ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਅੱਜ ਤੁਹਾਨੂੰ ਆਪਣੇ ਮਨਪਸੰਦ ਸਾਹਿਤਕ ਪਾਤਰ ਜਸਬੀਰ ਭੁੱਲਰ ਬਾਰੇ ਦੱਸਣਾ ਚਾਹੁੰਦਾ ਹਾਂ ਉਹ ਮੇਰਾ ਮਨਪਸੰਦ ਸਾਹਿਤਕ ਪਾਤਰ ਹੈ ਕਿਉਂਕਿ ਉਸੇ ਸਾਹਿਤ ਪੜ੍ਹਨ ਤੋਂ ਸਾਨੂੰ ਬਹੁਤ ਸਾਰੀ ਸ਼ਿਕਸ਼ਾ ਜਿਹੜੀ ਆ ਪ੍ਰਾਪਤ ਹੁੰਦੀ ਹੈ ਮੈਂ ਉਹਨਾਂ ਦੀ ਕਿਤਾਬ ਪਹਿਲਾ ਸਬਕ ਵਿੱਚੋਂ ਇੱਕ ਘਟਨਾ ਬਾਰੇ ਦੱਸਣਾ ਚਾਹਵਾਂਗਾ ਬਾਬਾ ਕਟਾਣੀ ਪਿੰਡ ਦਾ ਮੰਨਿਆ ਪਰਮੰਨਿਆ ਸਿਆਣਾ ਵਿਅਕਤੀ ਸੀ ਲੋਕ ਲੋੜ ਵੇਲੇ ਆਪਣੇ ਕੰਮਾਂ ਵਿੱਚ ਉਸ ਦੀ ਸਲਾਹ ਲੈਂਦੇ ਰਹਿੰਦੇ ਸਨ ਇੱਕ ਦਿਨ ਬਾਬਾ ਸੱਥ ਵਿੱਚ ਬੈਠਾ ਬੱਣ ਵੱਟ ਰਿਹਾ ਸੀ ਲਾਗਲੇ ਪਿੰਡੋਂ ਇੱਕ ਗੱਭਰੂ ਆਇਆ ਉਸਨੇ ਬਾਬੇ ਨੂੰ ਸਿਰ ਤੋਂ ਪੈਰ ਤੱਕ ਵੇਖਿਆ ਅਤੇ ਹਉਮੇ ਭਰੇ ਵਿੰਗ ਨਾਲ਼ ਮੁਸਕਰਾਇਆ ਉਸ ਗੱਭਰੂ ਨੇ ਬਾਬੇ ਨੂੰ ਕਿਹਾ ਮੈਂ ਇੱਕ ਵੱਡਾ ਆਦਮੀ ਬਣਨਾ ਚਾਹੁੰਦਾ ਹਾਂ ਬਾਪੂ ਆਖਦੇ ਕਿ ਮੈਨੂੰ ਬਾਬੇ ਦੀ ਸਿੱਖਿਆ ਦੀ ਲੋੜ ਹੈ ਮੈਨੂੰ ਹੋਰ ਵੀ ਬਹੁਤ ਕੰਮ ਸਨ ਪਰ ਬਾਪੂ ਦੇ ਵਾਰ ਵਾਰ ਕਹਿਣ 'ਤੇ ਆਉਣਾ ਪਿਆ ਬਾਬੇ ਦੇ ਬੁੱਲਾਂ 'ਤੇ ਨਵੀਂ ਜਿਹੀ ਮੁਸਕਾਨ ਆ ਗਈ ਤੂੰ ਪੰਡੋਰੀ ਵਾਲੇ ਹਜੂਰਾ ਸਿੰਘ ਭੂਰਾ ਦਾ ਪੁੱਤਰ ਹੈ ਤੂੰ ਭਾਵੇਂ ਰੁੱਝਿਆ ਹੋਵੇਗਾ ਪਰ ਮੈਂ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ ਜਿਵੇਂ ਤੇਰੀ ਮਰਜ਼ੀ ਠੀਕ ਹੈ ਅੱਜ ਮੈਂ ਤੈਨੂੰ ਇੱਕ ਨਿੱਕਾ ਜਿਹਾ ਸਬਕ ਪੜ੍ਹਾਵਾਂਗਾ ਤੂੰ ਛੇਤੀ ਵਿਹਲਾ ਹੋ ਜਾਵੇਗਾ ਗੱਭਰੂ ਚੁੱਪ ਰਿਹਾ ਪਰ ਮੇਰੀ ਇੱਕ ਸ਼ਰਤ ਹੈ ਸ਼ਰਤ ਗੱਭਰੂ ਹੈਰਾਨ ਜਿਹਾ ਹੋ ਗਿਆ ਮੈਂ ਤੈਨੂੰ ਮੁਫ਼ਤ ਪੜ੍ਹਾਵਾਂਗਾ ਵਿੱਦਿਆ ਦਾ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ ਨੇ ਗਿਆਨ ਵੰਡਿਆ ਹੋਰ ਵੱਧਦਾ ਹੈ ਜੇ ਮੈਂ ਜੋ ਸਬਕ ਤੈਨੂੰ ਪੜ੍ਹਾਵਾਂਗਾ ਉਸਦੀ ਉਲੰਘਣਾ ਨਹੀਂ ਕਰੇਗਾ ਤਾਂ ਉਲੰਘਣਾ ਕਰਨ ਦੇ ਨਾਲ਼ ਹਰ ਵਾਰ ਦਸ ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਮਨਜ਼ੂਰ ਹੈ ਸ਼ਰਤ ਦੀ ਗੱਲ ਸੁਣ ਕੇ ਸੱਥ ਵਿੱਚ ਬੈਠੇ ਦੂਜੇ ਲੋਕਾਂ ਨੇ ਉਹਨਾਂ ਵੱਲ ਧਿਆਨ ਖਿੱਚਿਆ ਗਿਆ ਉਹ ਸਾਰੇ ਖਿਸਕ ਕੇ ਉਹਨਾਂ ਦੇ ਨੇੜੇ ਹੋ ਗਏ ਬਾਬੇ ਨੇ ਬਾਣ ਦਾ ਵੱਟਿਆ ਹੋਇਆ ਪਿੰਨਾ ਪਾਸੇ ਰੱਖ ਦਿੱਤਾ ਅਤੇ ਬੋਲਿਆ ਅੱਜ ਦਾ ਸਬਕ ਬਸ ਇੰਨਾਂ ਹੀ ਹੈ ਹਮੇਸ਼ਾਂ ਸ਼ਾਂਤ ਰਹੋ ਧੰਨਵਾਦ